ਹੈਲੋ ਕੌਣ ਬੋਲਦਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਆ ਹਾਲ ਹੈ ਜੀ ਮੈਂ ਤਾਂ ਠੀਕ ਹੈ ਤੁਸੀਂ ਕਿਵੇਂ ਯਾਦ ਕਰਿਆ ਅੱਜ ਅੱਛਾ ਹੋਰ ਨਿਆਣੇ ਨਿੱਕੇ ਠੀਕ ਹੈ ਸਾਰੇ ਹਾਂਜੀ ਹਾਂਜੀ ਬੱਚੇ ਠੀਕ ਹੈ ਜੀ ਤੁਸੀਂ ਦੱਸੋ ਅੱਛਾ ਜੀ ਅੱਛਾ ਅੱਛਾ ਹੋਰ ਦੱਸੋ ਕਿਆ ਸੇਵਾ ਕਰੀਏ ਅੱਛਾ ਜੀ ਕਿਹੋ ਜਿਹਾ ਚਾਹੀਦਾ ਜੀ ਅੱਛਾ ਜੀ ਅੱਛਾ ਜੀ ਕੋਈ ਚੁਐਸ ਰੇਂਜ ਕਿੰਨੀ ਚਾਹੀਦੀ ਹੈ ਜੀ ਪੰਜ ਸੌ ਤੋਂ ਸਟਾਰਟਿੰਗ ਹੈ ਜੀ ਸੂਟਾਂ ਦੀ ਪੰਦਰ੍ਹਾਂ ਸੌ ਤੱਕ ਸਿਲਕ ਦਾ ਚਾਹੀਦਾ ਕੋਟਨ ਦਾ ਚਾਹੀਦਾ ਕਿਹੋ ਚਾਹੀਦਾ ਸਿਲਕ ਦਾ ਕਢਾਈ ਵਾਲਾ ਚਾਹੀਦਾ ਆ ਪਲੇਨ ਚਾਹੀਦਾ ਆ ਕਢਾਈ ਵਾਲਾ ਅੱਛਾ ਜੀ ਠੀਕ ਹੈ ਹੋਰ ਕੁਛ ਚੁੰਨੀ ਹੈਵੀ ਚਾਹੀਦੀ ਹੈ ਜਾਂ ਪਲੇਨ ਚਾਹੀਦੀ ਹੈ ਕਿੱਦਾਂ ਨਹੀਂ ਸੂਟ ਦੇ ਨਾਲ ਤਾਂ ਹੈਗੀ ਹੈ ਚੁੰਨੀ ਸੂਟ ਇੱਦਾਂ ਹੈ ਨਾ ਵੀ ਰੇਂਜ ਦੇ ਹਿਸਾਬ ਨਾਲ ਕੋਈ ਤਾਂ ਸੂਟ ਹੈਵੀ ਹੈ ਚੁੰਨੀ ਪਲੇਨ ਹੈ ਕਈਆਂ ਦੀ ਚੁੰਨੀ ਹੈਵੀ ਹੈ ਸੂਟ ਉਹ ਹੈ ਹਲਕੇ ਹੈ ਅੱਛਾ ਜੀ ਠੀਕ ਹੈ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਅਤੇ ਜੁੱਤੀ ਜੁੱਤੀਆਂ ਜੀ ਸਾਡੀ ਸ਼ੋਪ 'ਤੇ ਹੈਗੀਆਂ ਹੈ ਜੀ ਦੱਸੋ ਹਾਂਜੀ ਪੰਜਾਬੀ ਜੁੱਤੀ ਵੀ ਹੈ ਵੈਲੀ ਵੀ ਹੈ ਸੈਂਡਲ ਵੀ ਹੈ ਦੱਸੋ ਤੁਸੀਂ ਗਲੇ ਦਾ ਹਾਰ ਵੀ ਸੈੱਟ ਵੀ ਹੈਗੇ ਹੈ ਜੀ ਹਾਂਜੀ ਹਾਂਜੀ ਅਤੇ ਸੈੱਟ ਵੀ ਹੈਗੇ ਹੈ ਹਾਂਜੀ ਕਲਰ ਦੇ ਹਿਸਾਬ ਨਾਲ ਕਲਰ ਕਿਹੜਾ ਚਾਹੀਦਾ ਤੁਹਾਨੂੰ ਸੂਟ ਦਾ ਪਿੰਕ ਸੂਟ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਫਿਰ ਇੱਦਾਂ ਕਰਿਓ ਸਾਡੀ ਸ਼ੋਪ 'ਤੇ ਆ ਜਿਓ ਮੈਂ ਤੁਹਾਨੂੰ ਦਿਖਾ ਦੂੰਗੀ ਓਕੇ ਜੀ ਸਤਿ ਸ਼੍ਰੀ ਅਕਾਲ